ਪੰਜ ਅਕਤੂਬਰ ਦੋ ਹਜ਼ਾਰ ਵੀਹ ਅਠਾਰ੍ਹਾਂ ਜਨਵਰੀ ਉੱਨੀ ਸੌ ਪੈਂਠ ਇੱਕੀ ਜਨਵਰੀ ਉੱਨੀ ਸੌ ਠਾਨਵੇਂ ਚੌਦ੍ਹਾਂ ਅਗਸਤ ਉੱਨੀ ਸੌ ਪੈਂਠ ਅਤੇ ਤੇਰ੍ਹਾਂ ਨਵੰਬਰ ਦੋ ਹਜ਼ਾਰ ਤੇਈ